ਪਿਛਲੇ ਹਫ਼ਤੇ ਅਸੀਂ ਜੂਨ ਦੀਆਂ ਛੁੱਟੀਆਂ ਦੇ ਵਿੱਚ ਚੰਡੀਗੜ੍ਹ ਘੁੰਮਣ ਦੇ ਲਈ ਗਏ ਅਸੀਂ ਘੁੰਮਦੇ ਘੁੰਮਦੇ ਸੈਕਟਰ ਚੌਂਤੀ ਦੇ ਵਿੱਚ ਪਹੁੰਚ ਗਏ ਅਤੇ ਉੱਥੇ ਅਸੀਂ ਇੱਕ ਕਲਾ ਪ੍ਰਦਰਸ਼ਨੀ ਨੂੰ ਦੇਖਿਆ ਅਤੇ ਕਲਾ ਪ੍ਰਦਰਸ਼ਨੀ ਦੇ ਵਿੱਚ ਅਲੱਗ ਅਲੱਗ ਸਟੇਟਸ ਦੇ ਵਿੱਚੋਂ ਅਲੱਗ ਅਲੱਗ ਸ ਚੀਜ਼ਾਂ ਦਾ ਪ੍ਰਦਰਸ਼ਨ ਕਰਨ ਦੇ ਲਈ ਲੋਕ ਆਏ ਹੋਏ ਸੀ ਅਤੇ ਉਹਨਾਂ ਲੋਕਾਂ ਨੇ ਇੰਨੇ ਜ਼ਿਆਦਾ ਆਪਣੀਆਂ ਕਲਾ ਕਲਾ ਨੂੰ ਪ੍ਰਗਟ ਕੀਤਾ ਹੋਇਆ ਸੀ ਕਿ ਸਾਨੂੰ ਉੱਥੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇਖਣ ਦੇ ਵਿੱਚ ਪਸੰਦ ਆਈਆਂ ਅਤੇ ਉੱਥੇ ਲੋਕਾਂ ਨੇ ਆਪਣੀ ਸ ਸਿਲਾਈ ਕਢਾਈ ਅਤੇ ਹੱਥ ਤੋਂ ਬਣੀਆਂ ਚੀਜ਼ਾਂ ਚੀਨੀ ਮਿੱਟੀ ਤੋਂ ਬਣੀਆਂ ਚੀਜ਼ਾਂ ਦਾ ਪ੍ਰਦਰਸ਼ਨ ਕੀਤਾ ਅਤੇ ਅਸੀਂ ਉਹਨਾਂ ਚੀਜ਼ਾਂ ਨੂੰ ਦੇਖ ਦੇਖ ਕੇ ਬਹੁਤ ਆਕਰਸ਼ਿਤ ਹੋਏ ਅਤੇ ਉਹ ਆਕਰਸ਼ਿ ਉਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਅਸੀਂ ਅਨੰਦ ਮਾਣਿਆ ਮੈਂ ਅਤੇ ਮੇਰੀ ਸਿਸਟਰ ਨੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਕੁਝ ਚੀਜ਼ਾਂ ਸਾਨੂੰ ਬਹੁਤ ਪਸੰਦ ਆਈਆਂ ਬੱਟ ਇੱਕ ਚੀਜ਼ ਸਾਨੂੰ ਇੰਨੀ ਪਸੰਦ ਆਈ ਚੀਨੀ ਮਿੱਟੀ ਤੋਂ ਬਣੀ ਹੋਈ ਕਿ ਸਾਡੀ ਦੋਨਾਂ ਦੀ ਲੜਾਈ ਹੋ ਗਈ ਉਹ ਕਹਿ ਰਹੀ ਸੀ ਕਿ ਮੈਂ ਲਵਾਂਗੀ ਅਤੇ ਉਹ ਮੈਂ ਕਹਾਂ ਕਹਿ ਰਹੀ ਸੀ ਕਿ ਮੈਂ ਲਵਾਂਗੀ ਚਲੋ ਅਸੀਂ ਐਂਡ ਦੇ ਵਿੱਚ ਸੁਲਝਾ ਆਪਣਾ ਸਮਝੌਤਾ ਕੀਤਾ ਅਤੇ ਮੈਂ ਉਹ ਚੀਜ਼ ਨੂੰ ਪਰਚੇ ਖ਼ਰੀਦ ਲਿਆ ਅਤੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਉਸ ਤੋਂ ਬਾਅਦ ਅਸੀਂ ਹੱਥ ਨਾਲ ਬੁਣੀਆਂ ਹੋਈਆਂ ਖਰੋਸ਼ੀਏ ਦੀਆਂ ਚੀਜ਼ਾਂ ਦੇਖੀਆਂ ਖਰੋਸ਼ੀਏ ਦੇ ਸਵੈਟਰ ਅਤੇ ਮਫ਼ਰਲ ਬਣੇ ਹੋਏ ਦੇਖੇ ਉਹਨਾਂ ਦੇ ਵਿੱਚੋਂ ਇੱਕ ਮਫ਼ਰਲ ਮੈਂ ਆਪਣੇ ਲਈ ਖਰੀਦਿਆ ਅਤੇ ਮੈਨੂੰ ਉਹ ਮਫ਼ਰਲ ਸਰਦੀਆਂ ਦੇ ਵਿੱਚ ਮੇਰਾ ਬੜਾ ਕੰਮ ਆਵੇਗਾ